ਹੈਲੋ ਹਾਂਜੀ ਮੈਮ ਮੈਂ ਨਾ ਕਿਰਨ ਗੱਲ ਕਰਦੀ ਹਾਂ ਤੁਹਾਡੀ ਸਟੂਡੈਂਟ ਸਤਿ ਸ਼੍ਰੀ ਅਕਾਲ ਮੈਮ ਹਾਂਜੀ ਜੀ ਮੈਮ ਮੈਨੂੰ ਨਾ ਇੱਕ ਪ੍ਰੋਜੈਕਟ ਮਿਲਿਆ ਹੈਗਾ ਅਸੀਂ ਨਾ ਉਹ ਥੋੜ੍ਹਾ ਜਿਹਾ ਜਿੱਦਾਂ ਕੋਈ ਫੇਮਸ ਪਿੰਡ ਹੁੰਦਾ ਹੈ ਮੈਨੂੰ ਨਾ ਪਿੰਡਾ ਅਤੇ ਸ਼ਹਿਰਾਂ 'ਤੇ ਵਿਕਾਸ ਬਾਰੇ ਥੋੜ੍ਹਾ ਜਿਹਾ ਅਸੀਂ ਉਹ ਕਰਨਾ ਹੈ ਵੀ ਪ੍ਰੋਜੈਕਟ ਬਣਾਉਣਾ ਮੈਮ ਸਾਨੂੰ ਪਲੀਜ਼ ਮੈਨੂੰ ਕੋਈ ਉਹਨਾਂ ਬਾਰੇ ਥੋੜ੍ਹੀ ਜਾਣ ਇੰਫੋਰਮੇਸ਼ਨ ਦੇ ਦਿਉਂਗੇ ਤੁਸੀਂ ਹਾਂਜੀ ਹਾਂਜੀ ਹਾਂਜੀ ਹਾਂਜੀ ਓਕੇ ਮੈਮ ਹਾਂਜੀ ਹਾਂਜੀ ਜੀ ਠੀਕ ਹੈ ਮੈਮ ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਓਕੇ ਓਕੇ ਜੀ ਮੈਮ ਹਾਂਜੀ ਹਾਂਜੀ ਹਾਂਜੀ ਹਾਂਜੀ ਜੀ ਮੈਮ ਹਾਂਜੀ ਮੈਮ ਹ ਹਾਂਜੀ ਓਕੇ ਮੈਮ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਮ ਥੈਂਕ ਯੂ ਮੈਮ ਥੈਂਕ ਯੂ ਜੀ ਜੀ ਮੈਮ ਠੀਕ ਹੈ ਠੀਕ ਹੈ ਜੀ ਮੈਮ ਥੈਂਕ ਯੂ ਓਕੇ ਥੈਂਕ ਯੂ ਮੈਮ ਥੈਂਕ ਯੂ ਓਕੇ